ਹੈਲੋ ਸਤਿ ਸ਼੍ਰੀ ਅਕਾਲ ਮੈਡਮ ਅਸੀਂ ਸਿਵਲ ਹੋਸਪੀਟਲ ਤੋਂ ਬੋਲ ਰਹੇ ਹਾਂ ਕੀ ਤੁਸੀਂ ਕੁਲਵੰਤ ਕੋਰ ਹਾਂਜੀ ਹਾਂਜੀ ਮੈਡਮ ਅਸੀਂ ਸਿਵਲ ਹੋਸਪੀਟਲ ਤੋਂ ਬੋਲ ਰਹੇ ਹਾਂ ਤੁਸੀਂ ਪਿਛਲੇ ਹਫ਼ਤੇ ਸਾਡੇ ਹੋਸਪਿਟਲ ਦੇ ਵਿੱਚ ਆਏ ਸੀ ਆਪਣਾ ਚੈੱਕਅਪ ਕਰਵਾਉਣ ਲਈ ਹਾਂ ਹਾਂਜੀ ਅਸੀਂ ਤੁਹਾਨੂੰ ਪੁੱਛਣਾ ਸੀਗਾ ਕਿ ਹੁਣ ਤੁਹਾਡੀ ਸਿਹਤ ਕਿੱਦਾਂ ਹਾਂਜੀ ਅਸੀਂ ਨਾ ਉਹ ਹੀ ਇਨਕੁਆਇਰੀ ਕਰਨੀ ਹੁੰਦੀ ਆ ਅਸੀਂ ਆਪਣਾ ਮਤਲਬ ਕਿ ਸਾਡੇ ਤੋਂ ਹੋਮ ਵਿਜਿਟ ਤਾਂ ਹੁੰਦੀ ਨਹੀਂ ਅਸੀਂ ਕਾਲ ਕਰਕੇ ਹੀ ਆਪਣੇ ਮਰੀਜ਼ਾਂ ਦਾ ਹਾਲ ਚਾਲ ਪੁੱਛਦੇ ਹੁੰਦੇ ਹਾਂ ਅਤੇ ਅਸੀਂ ਪੁੱਛਣਾ ਸੀ ਜਿਵੇਂ ਤੁਹਾਨੂੰ ਲੂਜ਼ ਮੋਸ਼ਨ ਲੱਗੇ ਹੋਏ ਸੀ ਨਾਲੇ ਰੇਸ਼ਾ ਜੁਖਾਮ ਸੀ ਹੁਣ ਤੁਸੀਂ ਬਿਲਕੁਲ ਠੀਕ ਹੋ ਹਾਂਜੀ ਹਾਂਜੀ ਡਾਕਟਰ ਨੇ ਤੁਹਾਨੂੰ ਮਤਲਬ ਸਟੀਮ ਲੈਣ ਨੂੰ ਕਿਹਾ ਸੀ ਉਹ ਤੁਸੀਂ ਰੈਗੂਲਰ ਲੈ ਰਹੇ ਹੋ ਹਾਂਜੀ ਠੀਕ ਚਲੋ ਜੀ ਬਹੁਤ ਵਧੀਆ ਗੱਲ ਲੱਗੀ ਤੁਹਾਨੂੰ ਡਾਕਟਰ ਨੇ ਕਿਹਾ ਸੀ ਕਿ ਬਾਹਰਲਾ ਖਾਣਾ ਨਹੀਂ ਖਾਣਾ ਹੈਗਾ ਵੀ ਘਰ ਦੀ ਬਣਾਈ ਰੋਟੀ ਵਗੈਰਾ ਖਾਣੀ ਹੈ ਤੁਸੀਂ ਉਹ ਸਾਰਾ ਕੁਛ ਫੋਲੋ ਕਰ ਰਹੇ ਠੀਕ ਹੈ ਜੀ ਅਤੇ ਹੁਣ ਤੁਹਾਨੂੰ ਹੋਰ ਕੋਈ ਦਿੱਕਤ ਤਾਂ ਨਹੀਂ ਹੈ ਹਾਂਜੀ ਜੇ ਤੁਹਾਨੂੰ ਕੋਈ ਲੋੜ ਹੋਵੇ ਜਾਂ ਕੁਛ ਵੀ ਪੁੱਛਣਾ ਹੋਵੇ ਤੁਸੀਂ ਸਾਨੂੰ ਇਸ ਨੰਬਰ 'ਤੇ ਕਾਲ ਕਰ ਸਕਦੇ ਹੋ ਜੇ ਤੁਸੀਂ ਕੁਛ ਪੁੱਛਣਾ ਤਾਂ ਤੁਸੀਂ ਸਾਨੂੰ ਹੁਣ ਪੁੱਛ ਸਕਦੇ ਹੋ ਹਾਂਜੀ ਹਾਂਜੀ ਨਾਲੇ ਹਾਂਜੀ ਜਦੋਂ ਵੀ ਤੁਸੀਂ ਬਾਹਰ ਜਾਣਾ ਕਿਤੇ ਵੀ ਜਾਣਾ ਤਾਂ ਆਪਣੇ ਫੇਸ 'ਤੇ ਮਾਸਕ ਲੈ ਕੇ ਜਾਣਾ ਹੈ ਠੀਕ ਹੈ ਜੀ ਹਾਂਜੀ ਇਹਦੇ ਨਾਲ ਪਤਾ ਕੀ ਹੁੰਦਾ ਜਿਹੜੇ ਬਾਹਰ ਜਿਵੇਂ ਹੁਣ ਆਪਣਾ ਜਿਹੜਾ ਪੰਜਾਬ ਹੈ ਬਹੁਤ ਪਲਿਊਸ਼ਨ ਵਾਲਾ ਹੈ ਨਾ ਜਦੋਂ ਆਪਾਂ ਬਾਹਰ ਜਾਂਦੇ ਹਾਂ ਤਾਂ ਆਪਾਂ ਨੂੰ ਐਲਰਜੀ ਹੋ ਜਾਂਦੀ ਹੈ ਅਤੇ ਉਹਦੇ ਨਾਲ ਦੁਬਾਰਾ ਆਪਣਾ ਪ੍ਰੋਬਲਮ ਹੋ ਜਾਂਦੀ ਹੈ ਇਸ ਕਰਕੇ ਪਹਿਲਾਂ ਹੀ ਆਪਣਾ ਪ੍ਰਹੇਜ ਰੱਖੋ ਮਾਸਕ ਵਗੈਰਾ ਲੈ ਕੇ ਜਾਓ ਆਪਣਾ ਠੀਕ ਹੈ ਜੀ ਹਾਂਜੀ ਹੈ ਠੀਕ ਹੈ ਜੀ ਅਤੇ ਹੋਰ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਨਹੀਂ ਨਹੀਂ ਨਹੀਂ ਅਸੀਂ ਹੋਸਪਿਟਲ ਦੇ ਵਿੱਚ ਹੀ ਹੁੰਦੀ ਹਾਂ ਅਤੇ ਜੇਕਰ ਤੁਹਾਨੂੰ ਕਿਸੇ ਵੀ ਟਾਈਮ ਸਾਡੀ ਲੋੜ ਪੈਂਦੀ ਹੈ ਫਿਰ ਤੁਸੀਂ ਜਿਹੜੇ ਤੁਹਾਡੇ ਘਰ ਦੇ ਨੇੜੇ ਆਸ਼ਾ ਵਰਕਰ ਹੈ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਉਹ ਤੁਹਾਨੂੰ ਮਤਲਬ ਕਿ ਆਪਣੇ ਘਰ ਦੇ ਨਜ਼ਦੀਕੀ ਚਾਹੇ ਡਿਸਪੈਂਸਰੀ ਦੇ ਵਿੱਚ ਲੈ ਕੇ ਆਵੇ ਚਾਹੇ ਮਤਲਬ ਸਾਡੇ ਹੋਸਪਿਟਲ ਦੇ ਵਿੱਚ ਲਿਆਵੇ ਜਿੱਦਾਂ ਮਤਲਬ ਕਿ ਤੁਹਾਨੂੰ ਲੋੜ ਹੋਏਗੀ ਉੱਦਾਂ ਮਤਲਬ ਕਿ ਅਸੀਂ ਤੁਹਾਡਾ ਟ੍ਰੀਟਮੈਂਟ ਕਰ ਦੇਵਾਂਗੇ ਹਾਂਜੀ ਹਾਂਜੀ ਠੀਕ ਐ ਜੀ ਠੀਕ ਐ ਜੀ ਧੰਨਵਾਦ ਮੈਡਮ ਹਾਂਜੀ ਹਾਂਜੀ ਓਕੇ ਜੀ